ਹਾਂ ਮੈਂ ਆਪਣੀ ਚਿੱਤਰਕਾਰੀ ਦੀ ਵਰਣਨ ਕਰ ਸਕਦੀ ਹਾਂ ਮੈਂ ਇੱਕ ਹਾਲ ਵਿੱਚ ਹੀ ਇੱਕ ਤਸਵੀਰ ਬਣਾਈ ਸੀਗੀ ਗੁਰੂ ਨਾਨਕ ਦੇਵ ਜੀ ਦੀ ਅਤੇ ਮੈਂ ਉਹਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਉਹ ਪੇਂਟਿੰਗ ਬਣਵਾ ਬਣਾਈ ਆ ਅਤੇ ਮੈਨੂੰ ਬਹੁਤ ਸਾਰੇ ਉਹਦੇ ਵਿੱਚ ਮੈਂ ਕਲਰ ਯੂਜ ਕੀਤੇ ਆ ਬਹੁਤ ਸਾਰੇ ਔਨਲਾਈਨ ਵੀ ਦੇਖਿਆ ਅਤੇ ਕੁਝ ਕਿਤਾਬਾਂ ਵੀ ਪੜ੍ਹੀਆਂ ਬਹੁਤ ਸਾਰਾ ਕੁਝ ਇਤਿਹਾਸ ਵੇਖ ਕੇ ਮੈਂ ਉਹ ਤਸਵੀਰ ਬਣਾਈ ਆ ਅਤੇ ਮੈਨੂੰ ਸਾਰਿਆਂ ਨੇ ਬਹੁਤ ਕਿਹਾ ਕਿ ਤੂੰ ਬਹੁਤ ਵਧੀਆ ਤਰੀਕੇ ਨਾਲ ਵੀ ਬਣਾਈ ਆ ਅਤੇ ਮੈਨੂੰ ਬਹੁਤ ਚੰਗਾ ਲੱਗਦਾ ਜਦੋਂ ਕੋਈ ਉਹ ਪੇਂਟਿੰਗ ਵੇਖ ਕੇ ਮੇਰੀ ਤਾਰੀਫ਼ ਕਰਦਾ ਹੈ ਕਿ ਤੂੰ ਬਹੁਤ ਵਧੀਆ ਕੰਮ ਕੀਤਾ ਇਸ ਪੇਂਟਿੰਗ 'ਚ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਆ ਅਤੇ ਉਹ ਤਸਵੀਰ ਬਹੁਤ ਇਤਿਹਾਸ ਦਰਸਾਉਂਦੀ ਹੈ ਕਿ ਬਹੁਤ ਵਧੀਆ ਤਸਵੀਰ ਆ ਅਤੇ ਬਹੁਤ ਵਧੀਆ ਲੱਗਦਾ ਮੈਨੂੰ ਜਦੋਂ ਕੋਈ ਇਹ ਕਹਿੰਦਾ ਕਿ ਬਹੁਤ ਵਧੀਆ ਬਣਾਈ